ਸਾਡੇ ਪਿੰਡ ਵਿੱਚ ਜੋਤੀ ਅਤੇ ਤੋਸ਼ੇ ਦਾ ਬਿਜਨਸ ਬਹੁਤ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ ਜੋਤੀ ਜੋ ਕਿ ਪੂਰੇ ਪੰਜਾਬ ਵਿੱਚ ਬਹੁਤ ਹੀ ਫੇਮਸ ਹੈ ਅਤੇ ਤੋਸ਼ਾ ਜੋ ਸਿਰਫ ਫਾਜ਼ਿਲਕਾ ਵਿੱਚ ਹੀ ਬਣਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਸਨੂੰ ਐਕਸਪੋਰਟ ਕੀਤਾ ਜਾਂਦਾ ਹੈ ਇੱਥੇ ਬਹੁਤ ਹੀ ਵਧੀਆ ਕੁਆਲਿਟੀ ਦੀ ਜੋਤੀ ਬਣਾਈ ਜਾਂਦੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਐਕਸਪੋਰਟ ਕੀਤੀ ਜਾਂਦੀ ਹੈ ਇੱਥੋਂ ਦਾ ਤੋਸ਼ਾ ਇੱਕ ਬਹੁਤ ਵਧੀਆ ਮਿਠਾਈ ਹੈ ਜਿਸ ਨੂੰ ਬਾਹਰ ਵਿਦੇਸ਼ਾਂ ਵਿੱਚ ਵੀ ਬਹੁਤ ਮਾਣ ਮਿਲਿਆ ਹੈ ਅਤੇ ਬਹੁਤ ਲੋਕ ਇਸ ਨੂੰ ਪਸੰਦ ਕਰਦੇ ਹਨ ਫਾਜ਼ਿਲਕਾ ਦੀ ਜੋਤੀ ਅਤੇ ਤੋਸ਼ਾ ਇਸ ਦੀ ਸ਼ਾਨ ਹੈ ਜੋਤੀ ਤੋਸ਼ਾ ਜੋ ਕਿ ਇੱਕ ਮਿਠਾਈ ਹੈ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੇ ਹੈਰੀਟੇਜ ਵੱਲੋਂ ਵੀ ਅਤੇ ਜੋਤੀ ਨੂੰ ਵੀ ਹੈਰੀਟੇਜ਼ ਵੱਲੋਂ ਆਪਾਂ ਮਾਣ ਮਿਲਦਾ ਹੈ ਅਤੇ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ